ਸਮਾਜ ਵਿੱਚ ਡਾਂਸਰਾਂ ਨੂੰ ਬਹੁਤ ਇਹੋ ਜਿਹੀ ਚੁਣੌਤੀਆਂ ਹੁੰਦੀਆਂ ਹਨ ਜਿਹਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਆਰਕੈਸਟਰਾ ਲਾ ਲਉ ਓਹ ਸਾਡੇ ਵਿਆਹਾਂ 'ਤੇ ਆ ਕੇ ਨੱਚਦੀਆਂ ਹਨ ਪਰ ਓਹਨਾਂ 'ਚੋਂ ਸਾਡੇ ਹੀ ਭਾਈ ਭਰਾ ਹੁੰਦੇ ਹਨ ਜੋ ਓਹਨਾਂ ਨੂੰ ਬੁਰੀ ਨਜ਼ਰ ਨਾਲ ਦੇਖਦੇ ਹਨ ਜੋ ਕਿ ਬਹੁਤ ਗਲਤ ਚੀਜ਼ ਹੈ ਓਹ ਵੀ ਤਾਂ ਕਿਸੇ ਦੀ ਧੀ ਭੈਣ ਹੈਗੀ ਏ ਤਾਂ ਮਤਲਬ ਇਹੋ ਜਿਹੀ ਚੀਜ਼ਾਂ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਾਂ ਮੈਂ ਇੱਕ ਡਾਂਸਰ ਨੂੰ ਜਾਣਦੀ ਹਾਂ ਓਹ ਹੁਣ ਤਾਂ ਜੋੜੀ ਬਣਾ ਕੇ ਨੱਚਦੇ ਨੇ ਪਰ ਉਸ ਕੁੜੀ ਦਾ ਨਾਮ ਕਾਜਲ ਹੈ ਓਹ ਕਰਨਾਲ ਦੀ ਰਹਿਣ ਵਾਲੀ ਹੈ ਓਹਦੇ ਪਿਤਾ ਦੀ ਡੈਥ ਨੂੰ ਬਹੁਤ ਟੈਮ ਹੋ ਗਿਆ ਸੀ ਤਾਂ ਪਹਿਲਾਂ ਤਾਂ ਰਿਸ਼ਤੇਦਾਰਾਂ ਨੇ ਓਹਨਾਂ ਦਾ ਸਾਥ ਦਿੱਤਾ ਪਰ ਬਾਅਦ 'ਚ ਇੱਕ ਟੈਮ 'ਤੇ ਰਿਸ਼ਤੇਦਾਰ ਵੀ ਪੱਲਾ ਛਡਾ ਗਏ ਓਹ ਕੁੜੀ ਬਹੁਤ ਵਧੀਆ ਨੱਚਦੀ ਸੀ ਓਹਨੇ ਸੋਚਿਆ ਕਿ ਕਿਉਂ ਨਾ ਮੈਂ ਸ਼ੋ ਲਾਣੇ ਸ਼ੁਰੂ ਕਰ ਦੇਵਾਂ ਓਹ ਅੱਠ ਕੁ ਸਾਲਾਂ ਦੀ ਸੀ ਜਦੋਂ ਤੋਂ ਓਹਨੇ ਨੱਚਣਾ ਸ਼ੁਰੂ ਕੀਤਾ ਓਹ ਕਰਨਾਲ ਤੋਂ ਹੌਲੀ ਹੌਲੀ ਦ ਦੂਰ ਜਾਂਦੀ ਕੁਰੂਕਸ਼ੇਤਰ ਜਾਂਦੀ ਓਹਨੂੰ ਵਿਚਾਰੀ ਨੂੰ ਇੰਨਾਂ ਵੀ ਨਹੀਂ ਸੀ ਪਤਾ ਹੁੰਦਾ ਕਿ ਕਿਹੜੇ ਬੱਸ ਦਾ ਕਿੰਨਾਂ ਕਿਰਾਇਆ ਹੁੰਦਾ ਅਤੇ ਪੈਸੇ ਦਾ ਕਿਉਂਕਿ ਪੈਸੇ ਦਾ ਕੀ ਮਹੱਤਵ ਹੈ ਕਿਉਂਕਿ ਸੱਤ ਸਾਲ ਦੀ ਬੱਚੀ ਜਿਹੜੀ ਓਹ ਐਡੀ ਦੂਰ ਜਾ ਰਹੀ ਹੈ ਆਪਣੇ ਘਰ ਦਿਆਂ ਤੋਂ ਇਕੱਲੀ ਫਿਰ ਓਹਨੇ ਸ ਓਹਨੂੰ ਕਿਸੇ ਨੇ ਕਿਹਾ ਵੀ ਤੂੰ ਇੱਥੇੇ ਹੀ ਰਹਿ ਅਸੀਂ ਤੈਨੂੰ ਸ਼ੋ ਵੀ ਦਵਾਵਾਂਗੇ ਕੰਮ ਵੀ ਦਵਾਵਾਂਗੇ ਸਭ ਕੁਛ ਦਵਾਵਾਂਗੇ ਤਾਂ ਓਹਨੇ ਆਪਣੀ ਮਾਂ ਨੂੰ ਮਾਂ ਨਾਲ ਗੱਲ ਕੀਤੀ ਓਹਦੀ ਮਾਂ ਨੇ ਚਲੋ ਹਾਂ ਕਰ ਤੀ ਉੱਥੇ ਫਿਰ ਥੋੜ੍ਹੇ ਚਿਰਾਂ ਬਾਅਦ ਓਹਨੂੰ ਇੱਕ ਮੁੰਡਾ ਮਿਲਿਆ ਜੋ ਕਿ ਮੁੰਡਾ ਸੀਗਾ ਪੰਜਾਬ ਦਾ ਓਹ ਵੀ ਇੱਕ ਆਰਕੈਸਟਰਾ ਗਰੁੱਪ ਚਲਾਉਂਦਾ ਸੀ ਤਾਂ ਓਸ ਮੁੰਡੇ ਨੇ ਓਸ ਕੁੜੀ ਨੂੰ ਕਿਹਾ ਵੀ ਜੇ ਤੈਨੂੰ ਕਿਸੇ ਵੀ ਚੀਜ਼ ਦੀ ਕੋਈ ਲੋੜ ਹੋਵੇ ਤਾਂ ਤੂੰ ਜਦ ਮਰਜ਼ੀ ਮੈਨੂੰ ਫੋਨ ਕਰ ਸਕਦੀ ਹੈ ਪਹਿਲਾਂ ਤਾਂ ਓਹ ਕੁੜੀ ਬਹੁਤ ਸੰਗੀ ਕਿਉਂਕਿ ਉਹ ਓਸ ਟਾਇਮ ਉਸ ਕੁੜੀ ਦੀ ਉਮਰ ਚੌਦ੍ਹਾਂ ਕੁ ਸਾਲ ਹੋ ਚੁੱਕੀ ਸੀ ਅਤੇ ਉਸ ਨੂੰ ਆਰਕੈਸਟਰਾ ਦੀ ਲੈਨ ਵਿੱਚ ਆਏ ਪੰਜ ਸਾਲ ਹੋ ਚੁੱਕੇ ਸਨ ਫਿਰ ਓਹਨੇ ਆਖਿਰਕਾਰ ਉਸ ਮੁੰਡੇ ਨੂੰ ਫੋਨ ਲਾ ਹੀ ਲਿੱਤਾ ਤਾਂ ਫਿਰ ਓਹਨਾਂ ਨੇ ਸੋਚਿਆ ਕਿਉਂ ਨਾ ਉਹ ਜੋੜੀ ਬਣਾ ਕੇ ਨੱਚਣ ਓਹਨੇ ਆਪਣੀ ਮਾਂ ਨਾਲ ਗੱਲ ਕੀਤੀ ਓਹਨੀ ਓਹਦੀ ਮਾਂ ਨੇ ਓਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਸੇਮ ਤਰ੍ਹਾਂ ਦੇ ਕੱਪੜੇ ਸਵਾਓ ਅਤੇ ਫਿਰ ਨੱਚੋ ਓਹਨਾਂ ਨੇ ਪਹਿਲਾਂ ਆਪਣੇ ਬੌਸ ਨਾਲ ਗੱਲ ਕੀਤੀ ਪਰ ਓਹਨਾਂ ਨੂੰ ਇਹ ਗੱਲ ਨਹੀਂ ਜਮੀ ਕਿਉਂਕਿ ਓਹਨਾਂ ਨੂੰ ਇਹ ਸੀ ਫਿਰ ਇਹਨਾਂ ਨੇ ਅਲੱਗ ਹੋ ਜਾਣਾ ਹੈ ਤਾਂ ਓਹਨਾ ਨੇ ਫਿਰ ਆਪਣਾ ਆਰਕੈਸਟਰਾ ਸ਼ੁਰੂ ਕੀਤਾ ਅਤੇ ਅੱਜ ਓਹਨਾਂ ਦਾ ਪੰਜਾਬ ਵਿੱਚ ਬਹੁਤ ਵੱਡਾ ਨਾਮ ਹੈ ਜਿਹਨਾਂ ਨੂੰ ਬਲੈਸਟਰ ਜੋੜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਇਸ ਕਹਾਣੀ ਤੋਂ ਮੈਂ ਇੰਨਾਂ ਕੁ ਪ੍ਰੇਰਿਤ ਹੋਈ ਕਿ ਜਿਵੇਂ ਓਹ ਕੁੜੀ ਨੇ ਕਿੰਨਾਂ ਕੁਛ ਕੀਤਾ ਆਪਣੇ ਲਈ ਅਤੇ ਆਪਣੇ ਘਰਦਿਆਂ ਲਈ ਇਸ ਕਰਕੇ ਸ ਹਰੇਕ ਕੁੜੀ ਨੂੰ ਇੰਨਾਂ ਕੁ ਹੀ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਦੇ ਸਿਰ 'ਤੇ ਡਿਪੈਨਡੀਡ ਨਾ ਰਹੇ ਅਤੇ ਆਪਣੇ ਆਪ ਓਹਦੀ ਜ਼ਿੰਦਗੀ ਵਿੱਚ ਸਟੈਂਡ ਹੋ ਸਕੇ ਅਤੇ ਆਪਣੇ ਘਰਦਿਆਂ ਲਈ ਇੰਨਾਂ ਕੁ ਕਮਾ ਸਕੇ ਕਿ ਆਪਣੇ ਮਾਂ ਬਾਪ ਨੂੰ ਖੁਸ਼ ਰੱਖ ਸਕੇ